ਹੈਲੋ ਗੁੱਡ ਮੋਰਨਿੰਗ ਸ ਗੁੱਡ ਈਵਨਿੰਗ ਸਰ ਸਰ ਮੈਂ ਨਾ ਤੁਹਾਡੇ ਸਕੂਲ 'ਚ ਮਤਲਬ ਅਡਮਿਸ਼ਨ ਲੈਣੀ ਸੀ ਅਤੇ ਕੀ ਫੈਸਿਲਟੀ ਮਿਲ ਸਕਦੀ ਹੈ ਅੱਛਾ ਹਾਂਜੀ ਹਾਂਜੀ ਲਾਇਬਰੇਰੀ ਹੋਏਗੀ ਸਰ ਇੱਕ ਨਾਲੇ ਨਾ ਇੱਕ ਪ੍ਰੌਬਲਮ ਹੈ ਉਹ ਨਾ ਮੇਰੀ ਘਰ ਦੀ ਕੰਡੀਸ਼ਨ ਥੋੜ੍ਹੀ ਠੀਕ ਨਹੀਂ ਹੈਗੀ ਤਾਂ ਮੈਂ ਇਸ ਕਰਕੇ ਫੀਸ ਥੋੜ੍ਹੀ ਜਿਹੀ ਨਹੀਂ ਦੇ ਸਕਦੀ ਹਾਂਜੀ ਹਾਂਜੀ ਠੀਕ ਹੈ ਅਤੇ ਬੁੱਕਸ ਵਗੈਰਾ ਦਾ ਕੋਈ ਕੀ ਹੈ ਮਤਲਬ ਹੋਏਗਾ ਠੀਕ ਹੈ ਓਕ